ਸਾਡੇ ਸੈਲਫ ਹੈਲਪ ਗਰੁੱਪ ਐਸ ਐਚ ਜੀ ਬਾਰੇ ਮੇਰੀ ਇਹੀ ਰਾਏ ਹੈ ਕੀ ਇਹ ਸਾਨੂੰ ਗਰੁੱਪ ਜੋ ਸਾਡੇ ਇਹ ਗਰੁੱਪ ਜੋ ਦੱਸਿਆ ਗਿਆ ਨਾ ਇਹ ਸਾਨੂੰ ਦੱਸਦਾ ਕੀ ਸਾਨੂੰ ਆਪਣੀ ਸੁਰੱਖਿਆ ਕਿੱਦਾਂ ਕਰਨੀ ਚਾਹੀਦੀ ਹੈ ਤੇ ਹੁਣ ਜੇ ਆਪਾਂ ਮੰਨ ਲਈਏ ਜਿੱਦਾਂ ਪੰਜਾਬ ਦੇ ਵਿੱਚ ਅੱਜ ਕੱਲ ਹਰ ਇੱਕ ਬੰਦਾ ਤੇ ਇੱਕ ਔਰਤ ਆਪਣੇ ਮੋਢੇ ਨਾਲ ਮੋਢਾ ਲਾ ਕੇ ਤੁਰਦੀ ਐ ਪਰ ਕਿੱਥੇ ਨਾ ਕਿੱਥੇ ਨਾ ਔਰਤ ਨੂੰ ਇਹ ਦੱਸਿਆ ਜਾਂਦਾ ਕਿ ਉਹ ਗਲਤ ਹ ਤੇ ਜਿਹਦੇ ਕਰਕੇ ਉਹ ਆਪਣੀ ਸੈਲਫ ਸੁਰੱਖਿਆ ਨਹੀਂ ਕਰ ਸਕਦੀ ਤੇ ਇਸ ਲਈ ਨਾ ਕੀ ਸਾਨੂੰ ਪਤਾ ਕੀ ਕਰਨਾ ਚਾਹੀਦਾ ਵਾ ਇਸ ਸੈਲਫ ਹੈਲਪ ਗਰੁੱਪ ਬਹੁਤ ਸਹੀ ਐ ਜਿਹਦੇ ਕਰਕੇ ਨਾ ਅਸੀਂ ਇਹ ਕਰ ਸਕਦੇ ਆ ਕੀ ਉਹ ਆਪਣੀ ਸੁਰੱਖਿਆ ਆਪ ਕਰ ਸਕਦੀ ਹੈ ਜਿਦਾਂ ਮਰਜ਼ੀ ਕਰੇ ਹੁਣ ਔਰਤਾਂ ਨੂੰ ਤਾਂ ਸਭ ਨੂੰ ਚੰਗੇ ਮੌਕੇ ਇਹੀ ਆ ਨਾ ਕੀ ਜੇ ਕੋਈ ਹੁਣ ਬੰਦਾ ਸਾਨੂੰ ਛੇੜਦਾ ਪਿਆ ਆਦਾ ਜਾਂਦਾ ਨਾ ਅਸੀਂ ਸਾਡੇ 'ਚ ਇੰਨੇ ਸੈਲਫ ਕੋਨਫੀਡੈਂਸ ਹੈ ਕੀ ਆਪਾਂ ਆਪਣੀ ਸੁਰੱਖਿਆ ਆਪ ਕਰ ਸਕਦੇ ਆਂ ਭਾਵੇਂ ਉਹਨੂੰ ਹੁਣ ਆਪਾਂ ਜਿੱਦਾਂ ਕਿ ਦੱਸਿਆ ਵੂਮੈਨ ਹੈਲਪ ਲਾਈਨ ਨੰਬਰ ਵੀ ਹੈ ਸਭ ਤੋਂ ਵੱਡਾ ਮੌਕਾ ਇਹ ਆ ਕਿ ਆਪਾਂ ਮੌਕੇ ਤੇ ਉਹਨਾਂ ਨੂੰ ਕਰ ਸਕਦੇ ਆ ਹੁਣ ਕਈ ਤਾਂ ਸਰਕਾਰਾਂ ਨੇ ਬਹੁਤ ਵਧੀਆ ਮੌਕੇ ਬਣਾਏ ਔਰਤਾਂ ਲਈ ਜਿੱਦਾਂ ਕਿ ਉਹਨਾਂ ਦੀਆਂ ਉਹਨਾਂ ਦੀ ਇਸ ਲੋਨ ਦੇ ਸਕੀਮਾਂ ਬਣਾ ਦਿੱਤੀਆਂ ਉਹਨਾਂ ਵਾਸਤੇ ਕੰਮ ਖੋਲ ਦਿੱਤੇ ਉਹਨਾਂ ਵਾਸਤੇ ਬਹੁਤ ਕੰਮ ਖੋਲੇ ਆ ਜਿਹਦੇ ਕਰਕੇ ਉਹ ਆਪਣੇ ਘਰੇ ਬਹਿ ਕੇ ਕੰਮ ਕਰ ਸਕਦੇ ਜੋ ਉਹਨਾਂ ਦੇ ਘਰਦੇ ਉਹਨਾਂ ਨੂੰ ਬਾਹਰ ਨਹੀਂ ਜਾਣ ਦਿੰਦੇ ਤੇ ਕੁੜੀਆਂ ਲਈ ਵੀ ਬਹੁਤ ਬੱਸਾਂ ਦਾ ਕਿਰਾਇਆ ਬੱਸਾਂ ਦਾ ਕਿਰਾਇਆ ਜੋ ਕਿ ਪੰਜਾਬ ਦੇ ਵਿੱਚ ਬਹੁਤ ਜਿਆਦਾ ਫਰੀ ਹੈ ਉਹ